ਹੈਲੋ ਹੈਲੋ ਹਾਂਜੀ ਮਨਦੀਪ ਸਿੰਘ ਗੱਲ ਕਰ ਰਹੇ ਹੋ ਜੀ ਹਾਂਜੀ ਵੀਰ ਜੀ ਮੈਂ ਢੋਲੇਆਲ਼ ਤੋਂ ਗੱਲ ਕਰ ਰਿਹਾ ਸੀਗਾ ਜੀ ਹਾਂ ਹਾਂਜੀ ਹੋਰ ਵੀਰ ਜੀ ਠੀਕ ਠਾਕ ਹੋ ਬਸ ਠੀਕ ਠਾਕ ਜੀ ਮੈਂ ਢੋਲੇਆਲ਼ ਤੋਂ ਗੱਲ ਕਰਦਾ ਸੀਗਾ ਜੀ ਤੁਹਾਡਾ ਮੈਂ ਨੰਬਰ ਲਿਆ ਸੀ ਕਿਸੇ ਬੰਦੇ ਤੋਂ ਹਾਂਜੀ ਜੀ ਪਲੰਬਰ ਦਾ ਕੰਮ ਜਾ ਕਰਵਾਉਣਾ ਸੀਗਾ ਜੀ ਆਪਾਂ ਘਰ ਅਤੇ ਆਪਣੇ ਮਕਾਨ ਲਗਭਗ ਸਾਰਾ ਰੈਡੀ ਹੋ ਗਿਆ ਅਤੇ ਆਪਣਾ ਘਰ ਘਰੇ ਆਪਣੇ ਕਿ ਕਹਿੰਦਾਂ ਟੈਲਾਂ ਵਾਲੇ ਲੱਗੇ ਵੇ ਨੇ ਅਤੇ ਆਪਣਾ ਟੂਟੀਆਂ ਦਾ ਕੰਮ ਬਾਕੀ ਆ ਪਲੰਬਰ ਦਾ ਸਾਰਾ ਈ ਜਾਣੀ ਕਿ ਏ ਟੂ ਜੈੱਡ ਸਾਰਾ ਕੰਮ ਬਾਕੀ ਆ ਜੀ ਆਪਣਾ ਹਾਂਜੀ ਹਾਂਜੀ ਸਾਰਾ ਬਾਕੀ ਹੈ ਅਤੇ ਆਪਣੇ ਪਹਿਲਾਂ ਤਾਂ ਆਪਣੇ ਟੈਂਕੀ ਰੱਖਣੀ ਇੱਕ ਉੱਪਰ ਅਤੇ ਬਾਕੀ ਨੀਚੇ ਆਪਣੇ ਬਾਥਰੂਮ 'ਚ ਸਾਰੀਆਂ ਟੂਟੀਆਂ ਲਗਵਾਉਣੀਆਂ ਨੇ ਅਤੇ ਇੱਕ ਆਪਾਂ ਨੇ ਜਾਣੀ ਕਿ ਜਿੱਥੇ ਟੈਂਕੀ ਰੱਖਣੀ ਉਹਦੇ ਨੁੱਕਰ 'ਚ ਆਪਾਂ ਇੱਕ ਟੁੱਟੀ ਹੋਰ ਲਗਾਉਣੀ ਜੇ ਮੰਨ ਲਉ ਹੱਥ ਹੁੱਥ ਧੋਣ ਨੂੰ ਹਾਂਜੀ ਨੁੱਕਰ ਦੇ ਟਾਂਕੀ ਦੇ ਨਾਲੇ ਨੁੱਕਰ 'ਤੇ ਕਿਉਂਕਿ ਆਪਾਂ ਕਬੂਤਰਾਂ ਦੇ ਸ਼ੌਕੀਨ ਹੈ ਮੰਨ ਲਉ ਮਾੜਾ ਮੋਟਾ ਕਬੂਤਰ ਕਬਾਤਰ ਰੱਖੇ ਵੇ ਨੇ ਆਪਣੇ ਕੋਠੇ 'ਤੇ ਅਤੇ ਉੱਥੇ ਆਪਾਂ ਮੰਨ ਲਉ ਪਾਣੀ ਪੂਣੀ ਭਰਨ ਨੂੰ ਵੀ ਸਹੀ ਰਹੇਗਾ ਕੰਮ ਅਤੇ ਬਾਕੀ ਥੱਲੇ ਆਪਣੇ ਰਸੋਈ 'ਚ ਹੋ ਜਾਣਗੀਆਂ ਟੁੱਟੀਆਂ ਇੱਕ ਦੋ ਹਾਂਜੀ ਅਤੇ ਆਪਣੇ ਇੱਕ ਪਾਰਕ ਬਣਾਇਆ ਵਾ ਆਪਾਂ ਨੇ ਉੱਥੇ ਅਤੇ ਪਾਰਕ ਦੇ ਪਾਰਕ ਦੇ ਕੋਲ ਵੀ ਇੱਕ ਟੂਟੀ ਲਵਾਉਣੀ ਅਤੇ ਬਾਕੀ ਉਹਦੇ ਪਾਰਕ ਦੇ ਵਿੱਚ ਨਾ ਛੋਟਾ ਜਿਹਾ ਫੁਹਾਰਾ ਜਿਹਾ ਲਵਾਉਣਾ ਆਪਾਂ ਨੇ ਹਾਂਜੀ ਅਤੇ ਬਾਕੀ ਹੋਰ ਇੱਕ ਦੋ ਟੂਟੀਆਂ ਹੋਣਗੀਆਂ ਬਾਕੀ ਮੈਨੂੰ ਹਿਸਾਬ ਕਿਤਾਬ ਦੱਸ ਦਿਓ ਮੈਂ ਤੁਹਾਡੇ ਕੋਲ ਆ ਜਾਊਂਗਾ ਤੁਹਾਨੂੰ ਲੈ ਜਾਊਂਗਾ ਨਾਲ ਬਿਠਾ ਕੇ ਹਾਂਜੀ ਹਾਂਜੀ ਉੱਪਰ ਵੀ ਲਾ ਦਿਓ ਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਆਹ ਸਾਰਾ ਹੀ ਹੈ ਬਾਕੀ ਮੈਂ ਤੁਹਾਨੂੰ ਲੈ ਜੂਗਾ ਅਤੇ ਆਪਣਾ ਮੈਨੂੰ ਹਿਸਾਬ ਕਿਤਾਬ ਲਾ ਕੇ ਦੱਸ ਦਿਓ ਹਾ ਹਾਂ ਤੁਸੀਂ ਹੀ ਆ ਜਿਓ ਚਲੋ ਆ ਵਧੀਆ ਰਹੇਗਾ ਕੰਮ ਤੁਸੀਂ ਹੀ ਆ ਜਿਓ ਚਲੋ ਠੀਕ ਹੈ ਜੀ ਠੀਕ ਹੈ ਜੀ ਓਕੇ ਵੀਰੇ